ਵੈਸੇ ਤਾਂ ਮੈਨੂੰ ਸਪੋਰਟਸ ਸ਼ੂਜ ਬਹੁਤ ਚੰਗੇ ਲੱਗਦੇ ਹਨ ਜਿਹਦੇ ਵਿੱਚ ਵੱਖ ਵੱਖ ਕੰਪਨੀਆਂ ਸਪੋਰਟਸ ਸ਼ੂਜ ਬਣਾਉਂਦੀਆਂ ਹਨ ਪੂਮਾ ਹੋ ਗਿਆ ਰੈਡ ਟੇਪ ਹੋ ਗਿਆ ਅਤੇ ਸਪਾਰਕਸ ਹੋ ਗਿਆ ਅਤੇ ਮੈਨੂੰ ਜਿਹੜੇ ਜ਼ਿਆਦਾ ਪਸੰਦ ਨੇ ਉਹ ਰੈਡ ਟੇਪ ਪੂਮਾ ਨੇਗੇ ਇਹ ਇਹ ਸ਼ੂਜ ਬਹੁਤ ਕੰਫਰਟੇਬਲ ਹੁੰਦੇ ਹਨ ਮੈਨੂੰ ਚੱਲਣ ਦੇ ਵਿੱਚ ਬਹੁਤ ਸੁਖਾਲਾ ਮਹਿਸੂਸ ਹੁੰਦਾ ਹੈ ਅਤੇ ਰਨਿੰਗ ਦੇ ਲਈ ਵੀ ਮੈਂ ਰੈਡ ਟੇਪ ਹੀ ਯੂਜ ਕਰਦਾ ਹਾਂ ਜਿਹਦੇ ਵਿੱਚ ਬਹੁਤ ਵਧੀਆ ਸਟੈਪ ਜਿਹੜੇ ਉਹ ਚੁੱਕੇ ਜਾਂਦੇ ਹਨ ਅਤੇ ਅਸੀਂ ਮਤਲਬ ਕਿ ਆਸਾਨ ਤਰੀਕੇ ਨਾਲ ਰਨਿੰਗ ਜਾਂ ਐਕਸਰਸਾਈਜ਼ ਕਰ ਸਕਦੇ ਹਾਂ ਅਤੇ ਉਸ ਤੋਂ ਅੱਗੇ ਖੇਡ ਕੱਪੜਿਆਂ ਬਾਰੇ ਮੇਰੇ ਕੋਲ ਕੋਈ ਖੇਡ ਕੱਪੜੇ ਜਿਵੇਂ ਲੋਅਰ ਟੀ ਸ਼ਰਟ ਅਤੇ ਇਹ ਸੀ ਮੈਂ ਯੂਜ ਕਰਦਾ ਹਾਂ ਅਤੇ ਬਾਕੀ ਮੈਨੂੰ ਸਾਰੇ ਤਰ੍ਹਾਂ ਦੇ ਜਿਹੜੇ ਡਰੈਸਿਸ ਨੇ ਉਹ ਕੰਫਰਟੇਬਲ ਲੱਗਦੇ ਨੇ ਸਾਰਾ ਪ ਸਾਰੇ ਤਰ੍ਹਾਂ ਦੇ ਪਹਿਰਾਵੇ ਮੈਂ ਪਾਉਂਦਾ ਹਾਂ ਫੋਰਮਲ ਵੀ ਪਾਉਂਦਾ ਹਾਂ ਜੀਨ ਟੀ ਸ਼ਰਟ ਸ਼ਰਟ ਵਗੈਰਾ ਵੀ ਪਾਉਂਦਾ ਹਾਂ ਅਤੇ ਮੈਨੂੰ ਹਰ ਇੱਕ ਜਿਹੜਾ ਪਹਿਰਾਵਾ ਉਹ ਕੰਫਰਟੇਬਲ ਹੈ ਸ਼ੂਜ ਵਗੈਰਾ ਦੇ ਵਿੱਚ ਜਿਵੇਂ ਪੂਮਾ ਹੋ ਗਿਆ ਰੈਡ ਟੇਪ ਹੋ ਗਿਆ ਤਾਂ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸੁਖਾਲਾ ਮਹਿਸੂਸ ਹੁੰਦਾ ਹੈ ਅਤੇ ਮੈਂ ਡਿਊਟੀ 'ਤੇ ਵੀ ਜਾਂਦਾ ਹਾਂ ਤਾਂ ਵੀ ਮੈਂ ਇਹੀ ਸ਼ੂਜ਼ ਯੂਜ ਕਰਦਾ ਹਾਂ ਫੋਰਮਲ ਸ਼ੂਜ ਦੇ ਵਿੱਚ ਰੈਡ ਟੇਪ ਯੂਜ ਕਰਦਾ ਹਾਂ ਜਿਹਦੇ ਵਿੱਚ ਮੈਂ ਪਾਰਟੀ ਵੇਅਰ ਦੇ ਵਿੱਚ ਇਹ ਯੂਜ ਕਰਦਾ ਹਾਂ ਅਤੇ ਫੰਕਸ਼ਨ 'ਤੇ ਜੇ ਜਾਣਾ ਹੋਵੇ ਤਾਂ ਮੈਂ ਫੋਰਮਲ ਸ਼ੂਜ ਹੀ ਯੂਜ ਕਰਦਾ ਹਾਂ ਵੈਸੇ ਮੈਂ ਕੈਸੁਅਲ ਹੀ ਸਪੋਰਟਸ ਸ਼ੂਜ ਹੀ ਪਾਉਂਦਾ ਹਾਂ ਕਿਉਂਕਿ ਇਹਦੇ ਵਿੱਚ ਜਿਹੜਾ ਆਪਣਾ ਪੈਰ ਹੈ ਉਹ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦਾ ਹੈ ਅਤੇ ਬਾਕੀ ਲੋਅਰ ਟੀ ਸ਼ਰਟ ਮੈਂ ਜੋਗਿੰਗ ਕਰਨ ਦੇ ਲਈ ਯੂਜ ਕਰਦਾ ਹਾਂ ਅਤੇ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਆਰਾਮ ਮਹਿਸੂਸ ਹੁੰਦਾ ਹੈ ਸਹਿਜ ਮਹਿਸੂਸ ਹੁੰਦਾ ਹੈ